ਸਾਡੇ ਰਾਜ ਦੇ ਵਿੱਚ ਕਬੀਲਿਆਂ ਦੇ ਮੁੱਖ ਕਿੱਤੇ ਕੁਛ ਇਸ ਪ੍ਰਕਾਰ ਹਨ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜ਼ਿਮੀਂਦਾਰਾ ਕਿੱਤਾ ਹੈ ਜ਼ਿਮੀਂਦਾਰ ਆਪਣੀਆਂ ਅਲੱਗ ਅਲੱਗ ਕਿਸਮ ਦੀਆਂ ਫ਼ਸਲਾਂ ਆਪਣੇ ਖੇਤ ਦੇ ਵਿੱਚ ਉਗਾਉਂਦਾ ਹੈ ਜ ਜਿਸ ਤਰ੍ਹਾਂ ਕਣਕ ਝੋਨਾ ਗੰਨਾ ਮੱਕੀ ਦਾਲਾਂ ਅਤੇ ਮੂੰਗਫਲੀ ਆਦਿ ਇਸ ਤਰ੍ਹਾਂ ਹਰ ਇੱਕ ਜ਼ਿਮੀਂਦਾਰ ਆਪਣੇ ਖੇਤ ਦੇ ਵਿੱਚ ਵਧੀਆ ਤੋਂ ਵਧੀਆ ਬੀਜ ਬੋ ਕੇ ਵਧੀਆ ਫਸਲ ਦਾ ਨਿਕਾਲ ਕੱਢਦਾ ਹੈ ਅਤੇ ਮੰਡੀਆਂ ਦੇ ਵਿੱਚ ਵੇਚਦਾ ਹੈ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਇਸੇ ਤਰ੍ਹਾਂ ਕੁਛ ਲੋਕ ਛੋਟੇ ਵਰਗ ਦੇ ਹਨ ਜਿਵੇਂ ਗੁੱਜਰਵਾਲ਼ ਹਨ ਗੁੱਜਰਵਾਲ਼ਾਂ ਦਾ ਕੰਮ ਹੈ ਮੱਝਾਂ ਪਾਲਣਾ ਮੱਝਾਂ ਚਾਰਨੀਆਂ ਅਤੇ ਉਹਨਾਂ ਦਾ ਦੁੱਧ ਚੋਅ ਕੇ ਸ਼ਹਿਰਾਂ ਦੇ ਵਿੱਚ ਵੇਚਣਾ ਬੱਕਰੀਆਵਾਂ ਬੱਕਰਵਾਲ ਬੱਕਰੀਆਂ ਚਾਰਦੇ ਹਨ ਅਤੇ ਉਹਨਾਂ ਨੂੰ ਪਾਲਦੇ ਹਨ ਅਤੇ ਉਹਨਾਂ ਦਾ ਵੀ ਉਹ ਵੀ ਦੁੱਧ ਵੇਚਦੇ ਹਨ ਇਸੇ ਤਰ੍ਹਾਂ ਭੇਡਾਂ ਵਾਲੇ ਭੇਡਾਂ ਆਪਣੀਆਂ ਚਾਰਦੇ ਹਨ ਅਤੇ ਉਹਨਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ ਕੁਛ ਲੋਕ ਛੋਟੇ ਵਰਗ ਦੇ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਵੀਹ ਵੀਹ ਪੱਚੀ ਪੱਚੀ ਗਾਈਆਂ ਰੱਖੀਆਂ ਹਨ ਆਪਣੀਆਂ ਆਪਣੀਆਂ ਡੈਅਰੀਆਂ ਕਰੀਆਂ ਹੋਈਆਂ ਹਨ ਅਤੇ ਆਪਣੀ ਆਪਣੀ ਡੈਅਰੀ ਦੇ ਵਿੱਚ ਵਧੀਆ ਗਾਈਆਂ ਦਾ ਲਿਆ ਕੇ ਦੁੱਧ ਫਿਰ ਵੇਚ ਡੈਅਰੀਆਂ ਵਿੱਚ ਪਾਉਂਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ ਕੁਛ ਲੋਕ ਦਰਿਆਈ ਇਲਾਕੇ ਦੇ ਵਿੱਚ ਹਨ ਜੋ ਕਿ ਮੱਛੀ ਪਾਲਣ ਦਾ ਕੰਮ ਕਰਦੇ ਹਨ ਅਤੇ ਦਰਿਆ 'ਚੋਂ ਵੀ ਮੱਛੀ ਫੜਦੇ ਹਨ ਅਤੇ ਬਾਜ਼ਾਰ ਦੇ ਵਿੱਚ ਵੇਚਦੇ ਹਨ ਅਤੇ ਕੁਛ ਲੋਕ ਫੜੀਆਂ ਲਗਾ ਕੇ ਵੀ ਆਪਣੀ ਮੱਛੀ ਨੂੰ ਆਪ ਵੇਚਦੇ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਕੁਝ ਲੋਕ ਰਾਜਸਥਾਨ ਤੋਂ ਮੁਸਲਮਾਨ ਕਾਸ਼ਟ ਦੇ ਪੰਜਾਬ ਦੇ ਵਿੱਚ ਆਏ ਨੇ ਉਹ ਜ਼ਮੀਨ ਠੇਕੇ 'ਤੇ ਲੈ ਕੇ ਆਪਣੀ ਸਬਜ਼ੀ ਆਪ ਉਗਾਉਂਦੇ ਹਨ ਅਤੇ ਉਹਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਸ਼ਹਿਰ ਦੇ ਵਿੱਚ ਮੰਡੀ ਦੇ ਵਿੱਚ ਲਿਜਾ ਕੇ ਵੇਚਦੇ ਹਨ ਅਤੇ ਜਾਂ ਫਿਰ ਆਪਣੀਆਂ ਫੜੀਆਂ ਲਗਾ ਕੇ ਵੀ ਵੇਚਦੇ ਹਨ ਕੁਛ ਲੋਕ ਕਲਾ ਦੇ ਤੌਰ 'ਤੇ ਜਿਸ ਤਰ੍ਹਾਂ ਘੁਮਿਆਰ ਜਾਤ ਹੈ ਉਹ ਮਿੱਟੀ ਦੇ ਅਲੱਗ ਅਲੱਗ ਕਿਸਮ ਦੇ ਭਾਂਡੇ ਬਣਾ ਕੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੇਚਦੇ ਹਨ ਅਤੇ ਸਭ ਤੋਂ ਮਸ਼ਹੂਰ ਜਿਸ ਤਰ੍ਹਾਂ ਘੁਮਿਆਰ ਦਾ ਘੜਾ ਬਣਾਇਆ ਹੋਵੇ ਉਹ ਆਪਣੇ ਘਰਾਂ ਦੇ ਵਿੱਚ ਪਾਣੀ ਦਾ ਭਰ ਕੇ ਰੱਖੋ ਅਤੇ ਪਾਣੀ ਠੰਡਾ ਹੋ ਜਾਂਦਾ ਹੈ ਅਤੇ ਪੀਣ ਨੂੰ ਬਹੁਤ ਹੀ ਮਿੱਠਾ ਲੱਗਦਾ ਹੈ ਇੱਕ ਜਾਤ ਹੋਰ ਹੈ ਜਿਸ ਤਰਾਂ ਕਿ ਝਿਊਰ ਜਾਤ ਹੈ ਉਹ ਤੂਤ ਦੀਆਂ ਛਿਟੀਆਂ ਦੀਆਂ ਟੋਕਰੀਆਂ ਟੋਕਰੇ ਆਦਿ ਬਣਾ ਕੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੇਚਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ